ਪੰਜਾਬ ਦੇ ਗੀਤਾਂ ਦਾ ਇਤਿਹਾਸ ਬਹੁਤ ਹੀ ਵਿਸ਼ਾਲ ਰਿਆ ਹੈ ਸਮੇਂ ਦੇ ਨਾਲ ਪੰਜਾਬੀ ਗੀਤਾਂ ਵਿੱਚ ਬਹੁਤ ਬਦਲਾਅ ਆਇਆ ਹੈ ਪੁਰਾਨੇ ਗਾ ਗੀਤਾਂ ਅਤੇ ਨਵੇਂ ਗੀਤਾਂ ਵਿੱਚ ਕਈ ਤਰੀ ਤਰੱਕੀਆਂ ਨਾਲ ਅੰਤਰ ਪਾਇਆ ਜਾਂਦਾ ਹੈ ਜਿਵੇਂ ਕੀ ਬੋਲ ਸੰਗੀਤ ਸੰਸਕਾਰੀ ਪ੍ਰਭਾਵ ਅਤੇ ਮੋ ਮੋਜਿਕ ਸਟਾਈਲ ਬੋਲ ਅਤੇ ਵਿਸ਼ਾ ਬੋਲ ਅਤੇ ਵਿਸ਼ਾ ਵਿੱਚ ਵੀ ਬਹੁਤ ਜ਼ਿਆਦਾ ਅੰਤਰ ਮਿਲਿਆ ਹੈ ਜਿਵੇਂ ਪੁਰਾਨੇ ਪੰਜਾਬੀ ਗਾਨੇ ਜ਼ਿਆਦਾਤਰ ਪਿਆਰ ਸੰਸਕਾਰ ਲੋਕ ਕਹਾਨੀਆਂ ਅਤੇ ਗਾਵਾਂ ਧੀਆਂ ਦੀ ਜਿੰਦਗੀ ਉੱਤੇ ਅਧਾਰਿਤ ਹੁੰਦੇ ਸਨ ਉਨ੍ਹਾਂ ਵਿੱਚ ਪੰਜਾਬੀ ਦੀ ਮਿੱਟੀ ਦੀ ਖ਼ੁਸ਼ਬੂ ਹੋਣੀ ਸੀ ਜਿਵੇਂ ਕੀ ਗੁਰਦਾਸ ਮਾਨ ਮਹਿਲਾ ਮਹਿਲਾ ਰਨਜੀਤ ਕੌਰ ਅਤੇ ਕੁਲਦੀਪ ਮਾਨਕ ਵਰਗੇ ਗਾਇਕ ਸੱਚੀ ਜਿੰਦਗੀ ਦੀ ਝਲਕ ਪੇਸ਼ ਕਰਦੇ ਹਨ ਦੂਜੇ ਪਾਸੇ ਨਵੇਂ ਪੰਜਾਬੀ ਗਾਣੇ ਬਹੁਤ ਵਧੇਰੇ ਪਾਰਟੀ ਸ਼ੋਹਰਤ ਕਾਰਾਂ ਪੈਸੇ ਅਤੇ ਗੈਂਗਸਟਰ ਜਿੰਦਗੀ ਉੱਤੇ ਅਧਾਰਿਤ ਹਨ ਦੂਜਾ ਇਹਦੇ ਵਿੱਚ ਬਦਲਾਅ ਹੈ ਸੰਗੀਤ ਰਚਨਾ ਵਿੱਚ ਪੁਰਾਨੇ ਗੀਤਾਂ ਵਿੱਚ ਸਾਧਾਰਨ ਤੇ ਮਿੱਠੇ ਸਾਜ ਵਰਤੇ ਜਾਂਦੇ ਹਨ ਜਿਵੇਂ ਕੀ ਤੂੰਬੀ ਹੋ ਗਿਆ ਡੋਲ ਚਿਮਟਾ ਅਤੇ ਸਾ ਸਾਰੰਗੀ ਐਹ ਸੰਗੀਤ ਲੋਕ ਗਾਇਕੀ ਅਤੇ ਰੂਹਾਨੀ ਪਿਆਰ ਨੂੰ ਦਰਸੋਂਦੇ ਸਨ ਨਵੇਂ ਪੰਜਾਬੀ ਗੀਤ ਨੂੰ ਜੇ ਦੇਖਿਆ ਜਾਵੇ ਇਹਦੇ ਵਿੱਚ ਜਿਆਦਾਤਰ ਵੈਸਟਰਨ ਬੀਟਾਂ ਵਰਤੀਆਂ ਜਾਂਦੀਆਂ ਹਨ ਜਿਵੇਂ ਕੀ ਹੋ ਗਿਆ ਹਿੱਪ ਹੋਪ ਰੈਪ ਅਤੇ ਹੋਰ ਵੀ ਬਹੁਤ ਕੁਛ ਪਰ ਵਰਤਿਆ ਜਾਂਦਾ ਹੈ ਪੰਜਾਬੀ ਗਾਣਿਆਂ ਵਿੱਚ ਨਵਾਂਪਨ ਲਿਆਇਆ ਹੈ ਪਰ ਇਸ ਨਾਲ ਪੰਜਾਬੀ ਲੋਕ ਸੰਗੀਤ ਦਾ ਅਭਾਰ ਵੀ ਹੋ ਗਿਆ ਹੈ ਤੇ ਤੀਜਾ ਅਸੀਂ ਕਹਿ ਸਕਦੇ ਆਂ ਸੰਸਕਾਰੀ ਪ੍ਰਭਾਵ ਪੁਰਾਨੇ ਗੀਤ ਪੰਜਾਬੀ ਦੇ ਸੰਸਕ੍ਰਿਤ ਅਤੇ ਇਤਿਹਾਸ ਨੂੰ ਬਚਾਉਣ ਵਿੱਚ ਅਹਿਮ ਭੂਮਿਕਾ ਰਖ ਨਿਭਾਉਂਦੇ ਸਨ ਉਨ੍ਹਾਂ ਵਿੱਚ ਵਿਰਾਸਤ ਪਿਆਰ ਧੀ ਮਾਂ ਦਾ ਪਿਆਰ ਪਿਓ ਤੇ ਬੱਚੇ ਦਾ ਪਿਆਰ ਸਾਰਾ ਕੁਛ ਦਿਖਾਇਆ ਜਾਂਦਾ ਸੀ ਸਾਰਿਆਂ ਦੀ ਝਲਕ ਮਿਲਦੀ ਸੀ ਪਰ ਹੁਣ ਨਵੇਂ ਗੀਤ ਜਿਹੜੇ ਹਨ ਉਨ੍ਹਾਂ ਨੂੰ ਦੁਨੀਆ ਭਰ ਵਿੱਚ ਮਸ਼ਹੂਰ ਕਰ ਦਿੱਤਾ ਗਿਆ ਪਰ ਬਹੁਤੇ ਗਾਣੇ ਹਿੰਸਾ ਸ਼ਰਾਬ ਅਤੇ ਆਸ਼ਕੀ ਵਰਗੀਆਂ ਗੱਲਾਂ ਨ ਉੱਤੇ ਜਿਆਦਾ ਜੋਰ ਦੇਣ ਲੱਗ ਹਨ ਜੋ ਕਿ ਮੇਰੇ ਖਿਆਲ ਨਾਲ ਸਈ ਨਈਂ ਹੈ ਕੀ ਉਨ੍ਹਾਂ ਨੂੰ ਸਾਰਾ ਸਾਰਾ ਕੁਛ ਈ ਦਿਖਾਣਾ ਚਾਈਦਾ ਬੱਟ ਉਨ੍ਹਾਂ ਨੇ ਪੰਜਾਬੀ ਗੀਤਾਂ ਨੇ ਜਿਹੜੇ ਅੱਜ ਕੱਲ੍ਹ ਦੇ ਨਵੇਂ ਗੀਤ ਨੇ ਉਨ੍ਹਾਂ ਨੇ ਦੋ ਚਾਰ ਹੀ ਫੜੇ ਹੋਏ ਮੁੱਦੇ ਜਿਨ੍ਹਾਂ ਦੇ ਉੱਤੇ ਉਹ ਗੱਲ ਕਰਦੇ ਹਨ ਜਿਵੇਂ ਕਿ ਅਸੀਂ ਪਿੱਛੇ ਜਿਹੇ ਦੇਖਿਆ ਹੀ ਸੀ ਕਿ ਸਿੱਧੂ ਮੂਸੇਵਾਲੇ ਦਾ ਦਿਹਾਂਤ ਹੋਇਆ ਸੀ ਤੇ ਲੋਕਾਂ ਨੇ ਉਸ ਤੇ ਵੀ ਗਾਣੇ ਬਣਾਣੇ ਸ਼ੁਰੂ ਕਰਤੇ ਸੀ ਜੋ ਕੀ ਗਲਤ ਗੱਲ ਨਈਂ ਐ ਪਰ ਮੇਰੇ ਅਨੁਸਾਰ ਉਹ ਇਨ੍ਹਾਂ ਨੂੰ ਏਨਾ ਜਿਆਦਾ ਕੀਤਾ ਇਨ੍ਹਾਂ ਨੇ ਕੀ ਗੀਤ ਈ ਬਨਾ ਤੇ ਤੇ ਚੋਥਾ ਅਸੀਂ ਕਹਿ ਸਕਦੇ ਭਾਸ਼ਾ ਭਾਸ਼ਾ ਵੀ ਇਨ੍ਹਾਂ ਦੀ ਬਹੁਤ ਸ਼ੁੱਧ ਹੁੰਦੀ ਸੀ ਪੁਰਾਨੇ ਗੀਤਾਂ ਦੀ ਬਹੁਤ ਜ਼ਿਆਦਾ ਸ਼ੁੱਧ ਹੁੰਦੀ ਸੀ ਵੀ ਹਰ ਇੱਕ ਜਿਹੜੀ ਕਹਿ ਦੋ ਹਰੇਕ ਲਾਈਨ ਜਿਹੜੀ ਸੀਗੀ ਉਹ ਸਮਝ ਆਂਦੀ ਸੀ ਪਰ ਹੁਣ ਜਿਹੜੇ ਨਵੇਂ ਗੀਤ ਹੈ ਉਨ੍ਹਾਂ ਵਿੱਚ ਪੰਜਾਬੀ ਕ ਗੀਤ ਜੇ ਖਾ ਰਹੇ ਹੋਣ ਨੇ ਉਹਦੇ ਨਾਲ ਈ ਅੰਗਰੇਜੀ ਦਾ ਅਤੇ ਪੰਜਾਬੀ ਦਾ ਮਿਕਸ ਬੋਲ ਵਰਤੇ ਜਾਂਦੇ ਹਨ ਜੋ ਕੀ ਨੌਜਵਾਨ ਪੀੜੀ ਨੂੰ ਆਕਰਸ਼ਿਤ ਕਰਦੇ ਹਨ ਪਰ ਕਈ ਵਾਰ ਗਾਣਿਆਂ ਦੀ ਗੈਰ ਬਹੁਤ ਜ਼ਿਆਦਾ ਗਲਤ ਇਹਨੂੰ ਯੂਜ ਕੀਤਾ ਵਰਤਿਆ ਜਾਂਦਾ ਐ ਤੇ ਦੂਜਾ ਮੈਨੂੰ ਮੈਂ ਤੇ ਕਹੂੰਗੀ ਕੀ ਮੈਨੂੰ ਜਿਹੜੇ ਪੁਰਾਨੇ ਸਮੇਂ ਦੇ ਗੀਤ ਨੇ ਉਹ ਬਹੁਤ ਜ਼ਿਆਦਾ ਪਸੰਦ ਹਨ ਜਿਵੇਂ ਕਿ ਹੋ ਗਿਆ ਲਤਾ ਮੰਗੇਸ਼ਕਰ ਦੇ ਵੀ ਗੀਤ ਬਹੁਤ ਵਧੀਆ ਹੁੰਦੇ ਹਨ ਤੇ ਪੰਜਾਬੀ ਗਾਣਿਆਂ ਵਿੱਚ ਬਹੁਤ ਵਧੀਆ ਗਏ ਜਾਂਦੇ ਸੀ ਪਹਿਲਾਂ ਪਰ ਹੁਣ ਸਾਰਾ ਮੇਰੇ ਅਨੁਸਾਰ ਕਹਿ ਲੋ ਕੀ ਬਹੁਤ ਠੀਕ ਠੀਕ ਗਾਣੇ ਗਏ ਜਾਂਦੇ ਐ ਤੇ ਉਨ੍ਹਾਂ ਦੇ ਵਿੱਚ ਕੋਈ ਮਤਲਬ ਨੀ ਹੁੰਦਾ ਤੇ ਉਨ੍ਹਾਂ ਵਿੱਚ ਕੋਈ ਏਦਾਂ ਨੀ ਹੁੰਦਾ ਕੀ ਹਾਂ ਕੀ ਤਾਡੇ ਤੇ ਕੀ ਕੋਈ ਅਸਰ ਵਧੀਆ ਨੀ ਪੈਂਦਾ ਮਤਲਬ ਬਹੁਤ ਮਾੜਾ ਅਸਰ ਪੈ ਜਾਂਦਾ ਐ ਤੇ ਜਸਟ ਮੈਂ ਏਹੀ ਕਹਿਣਾ ਚਾਹੂੰਗੀ ਸਾਰਿਆਂ ਦੀ ਆਪਨੀ ਆਪਨੀ ਸੋਚ ਹੁੰਦੀ ਆ ਕੀ ਕੌਨ ਕੀ ਪਸੰਦ ਕਰਦਾ ਐ ਪੁਰਾਨੇ ਅਤੇ ਨਵੇਂ ਗਾਣਿਆਂ ਵਿੱਚ ਦੋਵੇਂ ਦੀ ਆਪਨੀ ਮਹੱਤਤਾ ਹੈ ਤੇ ਪੁਰਾਨੇ ਗਾਨੇ ਪੰਜਾਬੀ ਸੰਸਕ੍ਰਿਤ ਅਤੇ ਵਿਰਾਸਤ ਨੂੰ ਜਿਉਂਦਾ ਰੱਖਦੇ ਹਨ ਜਦ ਕਿ ਨਵੇਂ ਗਾਨੇ ਜਿਹੜੇ ਹਨ ਪੰਜਾਬੀ ਸੰਗੀਤ ਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਮਸ਼ੂਰ ਕਰ ਰਹੇ ਹਨ ਜੇਕਰ ਪੁਰਾਨੀ ਰੂਹਾਨੀਅਤ ਦੇ ਨਵੇਂ ਨਪਾਵਨ ਦੀ ਮਿਲਾਪ ਹੋਵੇ ਤਾਂ ਪੰਜਾਬੀ ਗੀਤ ਸੰਗੀਤ ਹੋਰ ਵੀ ਉੱਚੀਆਂ ਛੂਹ ਸਕਦੇ ਹਨ ਧੰਨਵਾਦ